ਸਭ ਤੋਂ ਚੁਨੌਤੀਪੂਰਨ ਚੀਜ਼ ਮੈਂ ਬਣਾਈ ਹੋਈ ਹੈ ਦਾਲ ਕਿਉਂਕਿ ਸਾਡੇ ਜਿਹੜੇ ਦੇਸ਼ ਆ ਉਹਦੇ ਵਿੱਚ ਦਾਲ ਜਿਹੜੀ ਬਣਦੀ ਹੈ ਕਾਫੀ ਅਲੱਗ ਅਲੱਗ ਤਰੀਕੇ ਨਾਲ ਬਣਦੀ ਆ ਜਿੱਦਾਂ ਪਹਿਲੇ ਉਹਨੂੰ ਉਬਾਲੋ ਉਹਦੇ ਵਿੱਚ ਦਾਲ ਪਾਓ ਉਹਨੂੰ ਕੁੱਕਰ ਬੰਦ ਕਰੋ ਉਹਦੀ ਦੋ ਤਿੰਨ ਸੀਟੀਆਂ ਮਰਾਓ ਫਿਰ ਉਹਦੇ ਵਿੱਚ ਉਹਨੂੰ ਇੱਕ ਵੱਖਰੇ ਫਰਾਈ ਪੈਨ 'ਚ ਮਸਾਲਾ ਕੱਟੋ ਪਿਆਜ਼ ਕੱਟੋ ਟਮਾਟਰ ਤੜਕਾ ਲਗਾਓ ਫਿਰ ਉਹਨਾਂ ਦੇ ਵਿੱਚ ਪਾਓ ਹੈ ਤਾਂ ਚੀਜ਼ ਸੌਖੀ ਪਰ ਜਿਹੜਾ ਪਹਿਲੀ ਵਾਰ ਬਣਾਉਂਦਾ ਉਹਦੇ ਵਾਸਤੇ ਬਹੁਤ ਔਖੀ ਚੀਜ਼ ਹੈ ਇਸ ਤਰ੍ਹਾਂ ਮੈਂ ਪਹਿਲੀ ਵਾਰੀ ਜਦੋਂ ਬਣਾਈ ਸੀ ਦਾਲ ਤਾਂ ਮੈਂ ਉਬਾਲ ਲਈ ਪਰ ਇਹਦਾ ਕਿ ਮੈਂ ਇਹਦੇ 'ਚ ਨਮਕ ਨਹੀਂ ਪਾਇਆ ਜਾਂ ਮੈਂ ਇਹਦੇ ਵਿੱਚ ਕਦੀ ਮਿਰਚ ਜ਼ਿਆਦਾ ਪਾ 'ਤੀ ਅਤੇ ਮੈਨੂੰ ਕਾਫੀ ਇੱਦਾਂ ਹੁੰਦਾ ਸੀ ਕਿ ਯਾਰ ਕਿਤੇ ਨਮਕ ਜ਼ਿਆਦਾ ਤਾਂ ਨਹੀਂ ਪੈ ਗਿਆ ਮਿਰਚ ਜ਼ਿਆਦਾ ਤਾਂ ਨਹੀਂ ਪੈ ਗਈ ਅਤੇ ਚਲੋ ਇਹ ਚੀਜ਼ ਤਾਂ ਹੋ ਗਈ ਉਬਾਲ ਤਾਂ ਲਈ ਦਾਲ ਮੈਂ ਜਦੋਂ ਮੇਰੇ ਤੜਕਾ ਲਗਾਉਣ ਦੀ ਵਾਰੀ ਆਈ ਤੜਕਾ ਲਗਾਉਣਾ ਜਿਹਨਾਂ ਜਿਹੜੇ ਰੈਗੂਲਰ ਜਿਹੜੇ ਤੜਕਾ ਮਤਲਬ ਕਿ ਜਿਵੇਂ ਜਿੱਦਾਂ ਸਾਡੀ ਮੰਮੀ ਹਨ ਉਹਨਾਂ ਨੂੰ ਤਾਂ ਹੋ ਜਾਂਦਾ ਕਿ ਪਤਾ ਲੱਗ ਜਾਂਦਾ ਕਿ ਤੜਕਾ ਇੱਦਾਂ ਲਗਾਉਣਾ ਪਰ ਹੁਣ ਜਿਹੜਾ ਆਪਾਂ ਤੜਕਾ ਲਗਾਉਣਾ ਏ ਅਤੇ ਸਾਨੂੰ ਤਾਂ ਪਤਾ ਨਹੀਂ ਨਾ ਕਿੰਨੀ ਮਿਰਚ ਪੈਣੀ ਹੈ ਕਿਸ ਹਿਸਾਬ ਦਾ ਕਿ ਮਿਰਚ ਤਾਂ ਮੈਂ ਪਹਿਲਾਂ ਵੀ ਉਹ 'ਚ ਵਿੱਚ ਪਾਈ ਹੋਈ ਹੈ ਅਤੇ ਮੈਂ ਇਹੀ ਸੋਚ ਸੋਚ ਕੇ ਕਾਫੀ ਦੇਰ ਸੋਚਦਾ ਰਿਹਾ ਕਿ ਕਿੰਨੀ ਮਿਰਚ ਪਾਵਾਂ ਕੀ ਕਰਾਂ ਕਿੰਨਾ ਨਮਕ ਪਾਵਾਂ ਪਰ ਹੱਦ ਮੈਂ ਜਦੋਂ ਆਪਣੇ ਹਿਸਾਬ ਨਾਲ ਜਿਹੜਾ ਨਮਕ ਪਾਇਆ ਅਤੇ ਤੜਕਾ ਲਗਾ ਕੇ ਦਾਲ 'ਚ ਪਾਈ ਅਤੇ ਫਿਰ ਮੈਂ ਜਦੋਂ ਉਹਨੂੰ ਜਿਹੜਾ ਤੜਕਾ ਸੀ ਉਹ ਦਾਲ ਵਿੱਚ ਪਾ 'ਤਾ ਅਤੇ ਬੰਦ ਕਰਕੇ ਉਹਦੀਆਂ ਸੀਟੀਆਂ ਮਰਾ ਕੇ ਅਤੇ ਵੇਟ ਕਰਦਾ ਰਿਹਾ ਕਿ ਕਦੋਂ ਕੋਈ ਆਵੇਗਾ ਅਤੇ ਉਹਨੂੰ ਖਾ ਕੇ ਦੱਸੇ ਕਿ ਕਿੱਦਾਂ ਦੀ ਬਣੀ ਕਿਉਂਕਿ ਮੈਂ ਖਾਧੀ ਤਾਂ ਮੈਨੂੰ ਪਤਾ ਮੈਂ ਕਹਿਣਾ ਸਹੀ ਬਣੀ ਹੈ ਇਸ ਕਰਕੇ ਮੈਂ ਕਿੰਨੀ ਦੇਰ ਵੇਟ ਕੀਤੀ ਫਿਰ ਮੇਰੇ ਫਾਦਰ ਆਏ ਅਤੇ ਮਦਰ ਆਈ ਅਤੇ ਉਹਨਾਂ ਨੇ ਖਾਧੀ ਉਹਨਾਂ ਨੇ ਕਿਹਾ ਕਿ ਥੋੜ੍ਹਾ ਨਮਕ ਮਿਰਚ ਉੱਪਰ ਥੱਲੇ ਆ ਪਰ ਉੱਦਾਂ ਬਣੀ ਸਹੀ ਆ ਇਸ ਕਰਕੇ ਕਾਫੀ ਵੱਖਰਾ ਐਕਸ ਐਕਸਪੀਰੀਅੰਸ ਰਿਹਾ ਕਿ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇਹਦੇ 'ਚ ਤਾਂ ਮਜ਼ੇ ਹੈ ਐਕਸਪੀਰੀਅੰਸ ਨਹੀਂ ਕਰਾਂਗੇ ਫਿਰ ਆਪਾਂ ਲਾਈਫ ਨਹੀਂ ਜੀ ਪਾਵਾਂਗੇ ਸਾਨੂੰ ਇੱਦਾਂ ਚੀਜ਼ਾਂ ਬਣਾਉਣੀ ਚਾਹੀਦੀਆਂ ਹਨ ਮੈਗੀ ਮੂਗੀ ਤਾਂ ਬਣਾਈ